ਸਤਿ ਸ਼੍ਰੀ ਅਕਾਲ ਮੈਂ ਪ੍ਰਿਆ ਜੇਕਰ ਪਰਿਵਾਰਿਕ ਪਕਵਾਨਾਂ ਦੀ ਗੱਲ ਕੀਤੀ ਜਾਏ ਜੋ ਪੀੜ੍ਹੀ ਤੋਂ ਪੀੜ੍ਹੀ ਦਰ ਚਲੀ ਆਉਂਦੀ ਹੈ ਉਹ ਹੈ ਮਿਸੀ ਰੋਟੀ ਇਹ ਮੈਂ ਆਪਣੀ ਮੰਮੀ ਤੋਂ ਮੇਰੀ ਮੰਮੀ ਨੇ ਸੱਸ ਤੋਂ ਔਰ ਮੇਰੀ ਸੱਸ ਮੇਰੀ ਦਾਦੀ ਨੇ ਆਪਣੀ ਸੱਸ ਤੋਂ ਸਿੱਖੀ ਅਤੇ ਉਹਨਾਂ ਦੀ ਸੱਸ ਨੇ ਵੀ ਆਪਣੇ ਬਜ਼ੁਰਗਾਂ ਤੋਂ ਸਿੱਖੀ ਹੈ ਜੇਕਰ ਮੈਂ ਇਸ ਦੀ ਰੈਸਿਪੀ ਦੀ ਗੱਲ ਕਰਾਂ ਤਾਂ ਇਹ ਆਟੇ ਵਿੱਚ ਦਾਲ ਜੋ ਮਾਂਹ ਚਨੇ ਦੀ ਦਾਲ ਹੈ ਉਸ ਨੂੰ ਪਾ ਕੇ ਆਟੇ ਨੂੰ ਗੁੰਨਿਆ ਜਾਂਦਾ ਹੈ ਅਤੇ ਉਸ ਵਿੱਚ ਆਪਣੀ ਪਸੰਦ ਦੇ ਅਨੁਸਾਰ ਕੋਈ ਸਬਜ਼ੀ ਅਗਰ ਪਾਉਣੀ ਚਾਹੋ ਤਾਂ ਪਾ ਸਕਦੇ ਹੋ ਵਿੱਚ ਘਿਓ ਪਾ ਸਕਦੇ ਹਾਂ ਅਤੇ ਵਿੱਚ ਪਿਆਜ਼ ਪਾ ਕੇ ਗੁੰਨ ਲਿਆ ਜਾਂਦਾ ਹੈ ਅਤੇ ਇਸ ਦੀਆ ਰੋਟੀਆਂ ਬਣਾਈਆਂ ਜਾਂਦੀਆਂ ਹਨ ਇਹਨਾਂ ਰੋਟੀਆਂ ਨੂੰ ਤੁਸੀਂ ਘਿਓ ਲਾ ਕੇ ਵੀ ਖਾ ਸਕਦੇ ਹੋ ਅਤੇ ਇਸ ਨੂੰ ਤਲ ਕੇ ਵੀ ਖਾ ਸਕਦੇ ਹੋ ਅਤੇ ਇਸ ਨਾਲ ਕੋਈ ਸਬਜ਼ੀ ਵੀ ਲੈ ਸਕਦੇ ਹੋ ਇਹ ਖਾਣ ਵਿੱਚ ਬਹੁਤ ਹੀ ਸਵਾਦਿਸ਼ਟ ਹੁੰਦੀਆਂ ਹਨ ਅਤੇ ਹੈਲਦੀ ਹੁੰਦੀਆਂ ਹਨ ਅਤੇ ਇਹ ਮਨ ਨੂੰ ਬਹੁਤ ਸਕੂਨ ਪਹੁੰਚਾਉਂਦੀਆ ਹਨ ਧੰਨਵਾਦ ਜੀ